ਸਾਡੇ ਇਲਾਕੇ ਵਿੱਚ ਬਹੁਤ ਪ੍ਰਸਿੱਧ ਸਕੂਲ ਹਨ ਜਿਵੇਂ ਕਿ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜੀ ਡੀ ਗੋਇੰਨਕਾ ਕੈਮਬਰੀਜ ਲੈਗਜੈਂਡਰ ਸਕੂਲ ਬਹੁਤ ਹੀ ਸਕੂਲ ਪ੍ਰਸਿੱਧ ਹਨ ਇਹਨਾਂ ਦੀ ਸਾਰੇ ਸਕੂਲਾਂ ਦੀ ਵਿਸ਼ੇਸ਼ਤਾ ਬਹੁਤ ਹੀ ਖ਼ਾਸ ਹੈ ਇਹਨਾਂ ਸਕੂਲਾਂ ਵਿੱਚ ਪੜ੍ਹਾਈ ਬਹੁਤ ਹੀ ਵਧੀਆ ਬਹੁਤ ਹੀ ਪੜ੍ਹਾਈ ਦਾ ਪੱਧਰ ਬਹੁਤ ਹੀ ਉੱਚਾ ਹੈ ਬੱਚਿਆਂ ਨੂੰ ਬਹੁਤ ਹੀ ਵਧੀਆ ਸਿੱਖਿਆ ਦਿੱਤੀ ਜਾਂਦੀ ਹੈ ਪੜ੍ਹਾਈ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਬੱਚਿਆਂ ਨੂੰ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਹਨ ਪੜ੍ਹਾਈ ਦਾ ਪੱਧਰ ਨਾਲ ਨਾਲ ਬੱਚਿਆਂ ਨੂੰ ਸ ਧਾਰਮਿਕ ਸਿੱਖਿਆ ਦਿੱਤੀ ਜਾਂਦੀ ਹੈ ਅੱਜ ਕੱਲ੍ਹ ਖੇਡਾਂ ਬਾਰੇ ਬਹੁਤ ਖੇਡਾਂ ਕੋ ਕਰਿਕਲ ਐਕਟੀਵਿਟੀਜ਼ ਬਹੁਤ ਸਾਰੀਆਂ ਬੱਚਿਆਂ ਨੂੰ ਕਰਾਈ ਜਾਂਦੀਆਂ ਹਨ ਅੱਜ ਕੱਲ੍ਹ ਪੜ੍ਹਾਈ ਨਵੀਂ ਤਕਨੀਕ ਨਾਲ ਕਰਾਈ ਜਾ ਰਹੀ ਹੈ ਸਕੂਲਾਂ ਵਿੱਚ ਸਮਾਰਟ ਕਲਾਸਾਂ ਰਾਹੀਂ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ ਬੱਚਿਆਂ ਦਾ ਦਿਮ ਬ ਦਿਮਾਗ ਵਿਕਸਿਤ ਕਰਨ ਲਈ ਹੋਰ ਵੀ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਐਕਟੀਵਿਟੀ ਵਿੱਚ ਬੱਚਿਆਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਪੜ੍ਹਾਈ ਦਾ ਪੱਧਰ ਵੀ ਬਹੁਤ ਹੀ ਜ਼ਿਆਦਾ ਵਧੀਆ ਕਰ ਦਿੱਤਾ ਗਿਆ ਹੈ ਬੱਚੇ ਬੱਚਿਆਂ ਨੂੰ ਸਕੂਲ ਵਿੱਚ ਬਹੁਤ ਹੀ ਵਧੀਆ ਸਿੱਖਿਆ ਮਿਲਦੀ ਹੈ ਇਸ ਦੇ ਨਾਲ ਜੇ ਆਪਾਂ ਵੱਡੇ ਸ਼ਹਿਰਾਂ ਦੇ ਸਕੂਲਾਂ ਨੂੰ ਜੇ ਤਰਜੀਹ ਦੇਈਏ ਤਾਂ ਉਹ ਹੋਣੀ ਬੱਚਿਆਂ ਦੀ ਪੜ੍ਹਾਈ ਦਾ ਮਿਆਦ ਵਧੀਆ ਹੋਣਾ ਚਾਹੀਦਾ ਹੈ ਬੱਚੇ ਛੋਟੇ ਸ਼ਹਿਰਾਂ ਵਿੱਚ ਵੀ ਪੜ੍ਹਾਈ ਦਾ ਬਹੁਤ ਹੀ ਵਧੀਆ